ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਮਿਸਤਰੀ ਬੋਲਦੇ ਹੋ ਜੀ ਅਸੀਂ ਵਾਸ਼ ਅਸੀਂ ਵਾਸ਼ਰੂਮ ਬਣਵਾਉਣੇ ਸੀਗੇ ਤੁਸੀਂ ਦੱਸ ਦਿਓ ਵੀ ਸਾਨੂੰ ਕੀ ਕੀ ਸਮਾਨ ਦਾ ਖਰਚਾ ਆਊਗਾ ਸਾਡਾ ਲੰਬਾਈ ਹੈ ਦਸ ਫੁੱਟ ਅਤੇ ਚੌੜਾਈ ਹਾਂਜੀ ਉਹ ਅਸੀਂ ਵਿਚ ਹੀ ਕਰਾਉਣਾ ਸੈਟਲ ਜੀ ਹਾਂਜੀ ਤੁਸੀਂ ਸੀਮੇਂਟ ਅਤੇ ਇੱਟਾਂ ਦਾ ਹੀ ਕੰਮ ਕਰਨਾ ਜੀ ਹਾਂਜੀ ਅਤੇ ਅਸੀਂ ਬਾਥਰੂਮਾਂ 'ਚ ਜੀ ਟੈਲ ਲਗਵਾਉਣੀ ਆ ਵੀ ਦੱਸ ਦਿਓ ਜੀ ਹਾਂਜੀ ਸਾਨੂੰ ਸਾਰਾ ਕੁਛ ਦੱਸ ਦਿਓ ਤੁਹਾਡੀ ਦਿਹਾੜੀ ਕਿੰਨੀ ਹੈ ਜੀ ਓਕੇ ਜੀ ਅਤੇ ਸਾਨੂੰ ਸਮਾਨ ਵੀ ਦੱਸ ਦਵੋ ਜੀ ਜਿਵੇਂ ਜੀ ਵਿਦੇਸ਼ੀ ਸੀਮੇਂਟ ਟੈਲਾਂ ਜੀ ਹਾਂਜੀ ਤੁਸੀਂ ਦੀ ਫੀਟਿੰਗ ਵੀ ਵਿੱਚੇ ਕਰਾਉਂਗੇ ਕਿ ਸਾਈਡ 'ਤੇ ਕਰਵਾਉਂਗੇ ਠੀਕ ਹੈ ਅਸੀਂ ਵਿੱਚ ਅਲੱਗ ਹੀ ਕੋਰਨਰ ਬਣਾਉਣਾ ਜੀ ਉਹਦਾ ਹਾਂਜੀ ਕਿੰਨੇ ਕੁ ਦਿਨਾਂ ਤੱਕ ਕੰਮ ਹੋਜੂ ਜੀ ਠੀਕ ਹੈ ਜੀ